ਵਿਆਹ ਵਿੱਚ ਵੱਡੇ ਵਿਆਹ ਵਿੱਚ ਵੱਡੇ ਸਮਾਰੋਹ ਵਿੱਚ ਵੱਡੀ ਮਾਤਰਾ ਪਾਣੀ ਦੀ ਇਕੱਠੀ ਕਰਨ ਲਈ ਕਾਫੀ ਪ੍ਰਬੰਧ ਕਰਨਾ ਪੈਂਦਾ ਹੈ ਜਿਵੇਂ ਕਿ ਕੇਅਰਫੁੱਲ ਪਲੈਨਿੰਗ ਕਰਨੀ ਪੈਂਦੀ ਆ ਸਹੀ ਪਲੈਨਿੰਗ ਹੋਣੀ ਚਾਹੀਦੀ ਕੋਰਡੀਨੇਸ਼ਨ ਹੋਣੀ ਚਾਹੀਦੀ ਵੀ ਕਿੰਨੇ ਗੈਸਟ ਆ ਰਹੇ ਆ ਹਰ ਇੱਕ ਪਰਸਨ ਕਿੰਨਾ ਪਾਣੀ ਪੀ ਸਕਦਾ ਡਿਪੈਂਡ ਕਰਦਾ ਹੈ ਵੈਦਰ ਕਿੱਦਾਂ ਦੇ ਹਨ ਉਹ ਸਾਰੀਆਂ ਚੀਜ਼ਾਂ ਨਜ਼ਰ ਰੱਖ ਕੇ ਹੀ ਵੱਡੀ ਮਾਤਰਾ 'ਤੇ ਪਾਣੀ ਦਾ ਜਿਹੜਾ ਕਿੰਨੀ ਕੁਆਂਟਿਟੀ ਲੱਗਦੀ ਆ ਉਹ ਸਾਰਾ ਪਾਣੀ ਦੀ ਕਿੰਨੀ ਨੀਡ ਆ ਕਿੰਨੀ ਵਰਤੋਂ ਹੋਣੀ ਆ ਉਹ ਜਮ੍ਹਾਂ ਕਰ ਸਕਦੇ ਹਨ ਜਿਵੇਂ ਕਿ ਦੇਖ ਸਕਦੇ ਹਾਂ ਵੀ ਕਿੰਨੇ ਗੈਸਟ ਆ ਰਹੇ ਹਨ ਉਹ ਗੈਸਟਾਂ ਦੇ ਤੋਰਾਨ 'ਤੇ ਇੱਕ ਬੰਦਾ ਇੱਕ ਲੀਟਰ ਪਾਣੀ ਪੀ ਸਕਦਾ ਹਨ ਜੇ ਪੰਜਾਹ ਬੰਦੇ ਹਨ ਤਾਂ ਉਹਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਪਾਣੀ ਚਾਹੀਦਾ ਹਾ ਵੀ ਪੰਜਾਹ ਲੀਟਰ ਤਾਂ ਚਾਹੀਦਾ ਹੀ ਹੈ ਪਾਣੀ ਉੱਦੂ ਵੱਧ ਆਪਾਂ ਹੋਰ ਕੰਮਾਂ ਲਈ ਵੀ ਜਿਵੇਂ ਕਿ ਉੱਥੇ ਕੂਲਰਸ ਹੋਣਗੇ ਜੇ ਗਰਮੀ ਦਾ ਵੈਦਰ ਆ ਤਾਂ ਕੂਲਰ ਆ ਜੇ ਆਊਟਡੋਰ ਵਿਆਹ ਰੱਖ ਰਹੇ ਹਾਂ ਤਾਂ ਜ਼ਿਆਦਾ ਗਰਮੀ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ ਉਹ ਹਿਸਾਬ ਨਾਲ ਵੇਖ ਕੇ ਅਸੀਂ ਗੈਸਟ ਕਾਊਂਟ ਕਰਕੇ ਪਾਣੀ ਉਸ ਹਿਸਾਬ ਨਾਲ ਲਿਆ ਸਕਦੇ ਹਾਂ ਬਾਕੀ ਵੈਦਰ ਦੇ ਅਕੋਰਡਿੰਗ ਜੇ ਵਿੰਟਰ ਸੀਜ਼ਨ ਹਨ ਤਾਂ ਪਾਣੀ ਬਹੁਤ ਘੱਟ ਵਰਤੋਂ ਹੁੰਦੀ ਆ ਵਿੰਟਰ ਸੀਜ਼ਨ ਦੇ ਵਿੱਚ ਤਾਂ ਕਰਕੇ ਆਪਾਂ ਘੱਟ ਪਾਣੀ ਲਿਆ ਸਕਦੇ ਹਨ ਅਤੇ ਆਪਾਂ ਕੈਟਰਿੰਗ ਕੋਰਡੀਨੇਸ਼ਨ ਵੀ ਕਰ ਸਕਦੇ ਹਾਂ ਜਿਵੇਂ ਕੈਟਰਿੰਗ ਵਿੱਚ ਵੀ ਕਾਫੀ ਪਾਣੀ ਯੂਜ਼ ਹੁੰਦਾ ਕੁਕਿੰਗ ਦੇ ਵਿੱਚ ਯੂਜ਼ ਹੁੰਦਾ ਜਿਵੇਂ ਸਟਾਫ ਅ ਕਾਫੀ ਸਟਾਫ ਯੂਜ਼ ਕਰਦਾ ਆਹਾ ਕੁਕਿੰਗ ਕਲੀਨਿੰਗ ਦੇ ਵਿੱਚ ਯੂਜ਼ ਕਰ ਸਕਦਾ ਉਹ ਪੂਰਾ ਕਿੰਨੇ ਲੀਟਰ ਪਾਣੀ ਯੂਜ਼ ਹੁੰਦਾ ਉਹ ਸਾਰਾ ਕਾਊਂਟ ਕਰਕੇ ਅਸੀਂ ਐਡ ਕਰਕੇ ਟੋਟੋਲ ਪਾਣੀ ਲਿਆ ਸਕਦੇ ਹਾਂ ਅਦਰਵਾਈਜ਼ ਆਪਾਂ ਐਮਰਜੈਂਸੀ ਵੋਟਰ ਸਪਲਾਈ ਵੀ ਬੈਕਅਪ ਵੀ ਸੋਰਸ ਰੱਖਣਾ ਚਾਹੀਦਾ ਹਨ ਜਿਵੇਂ ਕਿ ਐਕਸਟਰਾ ਵੋਟਰ ਹੋਣਾ ਚਾਹੀਦਾ ਬੋਟਲ ਵੋਟਰ ਹੋਣਾ ਚਾਹੀਦਾ ਡਿਸਪੈਂਸਰਸ ਹੋਣੇ ਚਾਹੀਦੇ ਆ ਵੱਡੀ ਟੈਂਕਸ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਆਪਾਂ ਇਜ਼ੀਲੀ ਵੋਟਰ ਜਿਹਦੇ 'ਚ ਸਟੋਰ ਹੋਜੇ ਲਾਰ ਲਾਰਜ਼ ਕੈਪੀਸਿਟੀ ਓਫ ਵੋਟਰ ਸਟੋਰ ਹੋ ਸਕਦਾ ਹੈ ਅਦਰਵਾਈਜ਼ ਆਪਾਂ ਪੋਰਟੇਬਲ ਥਿੰਗਸ ਯੂਜ਼ ਕਰ ਸਕਦੇ ਹਾਂ ਫੋਰ ਬ ਕੁਕਿੰਗ ਕਲੀਨਿੰਗ ਲਈ ਜੋ ਵੀ ਹੈ ਮਰੀਫੀਅਲ ਸਟੇਸ਼ਨਸ ਵੋਟਰ ਰੀਫਿਲ ਸਟੇਸ਼ਨਸ ਅਸੀਂ ਕਰ ਸਕਦੇ ਹਾਂ ਐਡ ਕਰ ਸਕਦੇ ਹਾਂ